ਰੂਪਨਗਰ ਜ਼ਿਲ੍ਹੇ ਵਿੱਚ ਆਵਾਜਾਈ ਦੇ ਮੁੱਖ ਵਿਕਲਪ ਸੜਕਾਂ ਅਤੇ ਰੇਲਵੇ ਸਟੇਸ਼ਨ ਵੀ ਹਨ ਸੜਕਾਂ ਵਿੱਚ ਆਟੋ ਰਿਕਸ਼ਾ ਬੱਸ ਰੇਲਵੇ ਸਟੇਸ਼ਨ ਵੀ ਹਨ ਜੇਕਰ ਇਨ੍ਹਾਂ ਦੀ ਕਿਰਾਏ ਦੀ ਗੱਲ ਕਰੀਏ ਤਾਂ ਵੀ ਇਨ੍ਹਾਂ ਦਾ ਕਿਰਾਇਆ ਬਹੁਤ ਸਸਤਾ ਹੈ ਜਿਵੇਂ ਬੱਸਾਂ ਵਿੱਚ ਸਫਰ ਕਰਨ ਲਈ ਲੇਡੀਜ਼ ਦਾ ਕਿਰਾਇਆ ਨਹੀਂ ਲੱਗਦਾ ਇਸ ਦੇ ਨਾਲ ਚੁਣੌਤੀਆਂ ਇਹ ਵੀ ਹਨ ਕਿ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਦਾ ਕੋਈ ਸਾਧਨ ਨਹੀਂ ਹੈ ਦੂਸਰੀ ਗੱਲ ਇਹ ਕਿ ਸਮੇਂ ਦੇ ਵੀ ਇਹ ਬੱਸਾਂ ਨਹੀਂ ਆਉਂਦੀਆਂ